ਹੈਲੋ ਮੀਸ਼ੋ ਸਰ ਸਰਵਿਸ ਸੈਂਟਰ ਪਹਿਲਾਂ ਮੈਂ ਤੁਹਾਡੇ ਤੋਂ ਹੀ ਪ੍ਰੋਡਕਟ ਓਰਡਰ ਕਰਵਾਉਂਦੀ ਹੁੰਦੀ ਸੀਗੀ ਜਿਹੜੇ ਕਿ ਪ੍ਰੋਡਕਟ ਬਹੁਤ ਹੀ ਵਧੀਆ ਸੀਗੇ ਹੁਣ ਮੈਂ ਇਸ ਵਾਰੀ ਮੇਰੇ ਬ੍ਰਦਰ ਦਾ ਬਰਡੇ ਸੀਗਾ ਉਹਦੇ ਲਈ ਮੈਂ ਟੀ ਸ਼ਰਟਸ ਓਰਡਰ ਕਰਵਾਈਆਂ ਸੀਗੀਆਂ ਜਿਹੜੇ ਕਿ ਤੁਹਾਡੇ ਸ਼ ਟੀ ਸ਼ਰਟਸ ਦੇ ਕਲਰ ਵਧੀਆ ਹੁੰਦੇ ਨੇਗੇ ਤੁਹਾਡੇ ਕੱਪੜੇ ਵਧੀਆ ਹੁੰਦੇ ਨੇਗੇ ਓ ਆ ਜਿਹੜੇ ਪ੍ਰੋਡਕਟ ਨੇ ਸਾਰੇ ਵਧੀਆ ਹੁੰਦੇ ਨੇ ਇਸ ਕਰਕੇ ਮੈਂ ਤੁਹਾਡੇ ਤੁਹਾਡੇ ਤੋਂ ਓਡਰ ਉਹ ਪ੍ਰੋਡਕਟ ਤੁਹਾਡੇ ਤੋਂ ਓਡਰ ਕਰਵਾਇਆ ਸੀਗਾ ਅਤੇ ਜਦ ਮੈਂ ਪ੍ਰੋਡਕਟ ਲੈਣ ਗਈ ਤਾਂ ਮੇਰੇ ਨਾਲ ਡਿਲੀਵਰੀ ਬੋਆਏ ਨੇ ਬਹੁਤ ਵਧੀਆ ਬੀਬਹੇ ਬੀਵਹੇਵ ਕੀਤਾ ਜਿਹੜਾ ਪ੍ਰੋਡਕਟ ਸੀ ਪੈਕ ਕੀਤਾ ਹੋਇਆ ਬਹੁਤ ਵਧੀਆ ਤਰੀਕੇ ਨਾਲ ਪੈਕ ਕੀਤਾ ਹੋਇਆ ਸੀਗਾ ਅਤੇ ਜਦੋਂ ਮੈਂ ਆਪਣੇ ਬ੍ਰਦਰ ਨੂੰ ਉਸ ਗਿਫਟ ਪੈਕ ਗਿਫਟ ਦਿੱਤਾ ਤਾਂ ਉਸਨੂੰ ਵਧੀਆ ਲੱਗਿਆ ਵੇਖ ਕੇ ਅਤੇ ਸੋ ਤੁਹਾਡਾ ਧੰਨਵਾਦ ਗਿਫਟ ਇੰਨੇ ਵਧੀਆ ਤਰੀਕੇ ਨਾਲ ਦੇਣ ਦਾ ਵਧੀਆ ਤੁਹਾਡੇ ਜਿਹੜੇ ਪ੍ਰੋ ਪ੍ਰੋਡਕਟ ਹੁੰਦੇ ਨੇ ਤਿਆਰ ਕਰਨ ਦੇ ਲਈ ਥੈਂਕ ਯੂ